ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀ ਭਾਸ਼ਾ ਜੋ ਕਿ ਮੇਰੀ ਮਾਤ ਭਾਸ਼ਾ ਹੈ ਉਸ ਨੂੰ ਬੋਲਣ ਵਿੱਚ ਵੈਸੇ ਤਾਂ ਮੈਨੂੰ ਕੋਈ ਵੀ ਮੁਸ਼ਕਿਲ ਇੱਦਾਂ ਆਈ ਨਹੀਂ ਪਰ ਫਿਰ ਵੀ ਕਦੇ ਕਦਾਈ ਇੱਕ ਇੱਕ ਦੋ ਵਾਰ ਮੈਨੂੰ ਪੜ੍ਹਨ ਜਾਂ ਸੁਣਨ ਵਿੱਚ ਮੁਸ਼ਕਿਲ ਆਈ ਸੀ ਪੰਜਾਬੀ ਭਾਸ਼ਾ ਦੇਖੋ ਐਸੀ ਭਾਸ਼ਾ ਹੈ ਜੋ ਕਿ ਇੰਡੀਆ ਹੀ ਨਹੀਂ ਬਲਕਿ ਵਰਡ 'ਤੇ ਗਿਆਰਵੇਂ ਨੰਬਰ 'ਤੇ ਜੋ ਕਿ ਸਭ ਤੋਂ ਵੱਧ ਬੋਲੀ ਜਾਂਦੀ ਹੈ ਇਸਨੇ ਆਪਣੇ ਆਪਣੀ ਕੁਆਲਿਟੀ ਦਾ ਸਬੂਤ ਆਪਣੇ ਗਿਆਰਵੇਂ ਨੰਬਰ 'ਤੇ ਹੋ ਕੇ ਦਿੱਤਾ ਹੈ ਅਤੇ ਮੈਨੂੰ ਆਸ ਹੈ ਕਿ ਅੱਗੇ ਹੋਰ ਵੀ ਪਹਿਲੇ ਜਾਂ ਦੂਸਰੇ ਨੰਬਰ 'ਤੇ ਆਵੇਗੀ ਪੰਜਾਬੀ ਭਾਸ਼ਾ ਨਾਲ ਮੇਰਾ ਸ਼ੁਰੂ ਤੋਂ ਹੀ ਲਗਾਅ ਰਿਹਾ ਹੈ ਕਿਉਂਕਿ ਮੈਂ ਪੰਜਾਬ ਦਾ ਵਸਨੀਕ ਹਾਂ ਜਿੱਥੇ ਸ਼ੁਰੂ ਤੋਂ ਹੀ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਪੜ੍ਹੀ ਜਾਂਦੀ ਹੈ ਲਿਖੀ ਜਾਂਦੀ ਹੈ ਸਮਝੀ ਜਾਂਦੀ ਹੈ ਇਸ ਕਰਕੇ ਇਸਨੂੰ ਇਹ ਮੈਨੂੰ ਦੱਸਣ 'ਚ ਕੋਈ ਹਰਜ਼ ਨਹੀਂ ਕਿ ਮੈਨੂੰ ਇਸ ਵਿੱਚ ਨੂੰ ਸਿੱਖਣ ਲਈ ਕੋਈ ਵੀ ਮੁਸ਼ਕਿਲ ਹਾਲਾਂਕਿ ਸ਼ੁਰੂਆਤ 'ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਇੱਦਾਂ ਦਾ ਕੋਈ ਵੀ ਮਸਲਾ ਨਹੀਂ ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜੋ ਕਿ ਪੂਰੇ ਦੁਨੀਆ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੈ ਇਸ ਨੂੰ ਬੋਲਣ 'ਤੇ ਜੋ ਮਿਠਾਸ ਮਨੋਬਿਰਤੀਆਂ ਜਾਂ ਬਲਬਲੇ ਨੇ ਜੋ ਆਪਣੇ ਮਨ ਅੰਦਰ ਪੂਰੇ ਹੁੰਦੇ ਨੇ ਉਹ ਕਿਸੇ ਹੋਰ ਭਾਸ਼ਾ ਵਿੱਚ ਮੈਂ ਸਮਝਦਾ ਹਾਂ ਮੇਰੇ ਅਕੋਰਡਿੰਗ ਨਹੀਂ ਹੋ ਸਕਦੇ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕੋਈ ਵੀ ਗੱਲਬਾਤ ਕਰਨੀ ਹੋਵੇ ਆਪਾਂ ਨੂੰ ਪੰਜਾਬੀ ਵਿੱਚ ਓਨਾ ਪੰਜਾਬੀ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਜੋ ਕਿ ਹੋਰ ਭਾਸ਼ਾ ਵਿੱਚ ਨਹੀਂ ਆਉਂਦਾ ਮੈਂ ਹੋਰ ਭਾਸ਼ਾਵਾਂ ਦੀ ਵੀ ਰਿਸਪੈਕਟ ਕਰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਹਾਂ ਪੰਜਾਬੀ ਭਾਸ਼ਾ ਇਕ ਅਜਿਹੀ ਭਾਸ਼ਾ ਹੈ ਜੋ ਕਿ ਮੇਰੇ ਦਿਲ ਦਿਮਾਗ ਮੇਰੇ ਸਰੀਰ ਵਿੱਚ ਇਸ ਤਰਾਂ ਫਿੱਟ ਹੈ ਕਿ ਜਿਸ ਇਸ ਨੂੰ ਮੇਰੇ ਤੋਂ ਕੋਈ ਵੱਖ ਨਹੀਂ ਕਰ ਸਕਦਾ